ਮੈਨੂੰ ਬਚਪਨ ਤੋਂ ਹੀ ਪੈਸੇ ਪੈਸੇ ਇਕੱਠੇ ਕਰਨ ਦਾ ਸਿੱਕੇ ਇਕੱਠੇ ਕਰਨ ਦਾ ਨੋਟ ਇਕੱਠੇ ਕਰਨ ਦਾ ਬਹੁਤ ਸ਼ੌਂਕ ਹੈ ਅਲੱਗ ਅਲੱਗ ਕਿਸਮ ਦੇ ਮੈਂ ਸਿੱਕੇ ਨੋਟ ਸਾਰੇ ਬਹੁਤ ਇਕੱਠੇ ਕਰਨ ਦਾ ਮੈਨੂੰ ਬਹੁਤ ਸ਼ੌਂਕ ਹੈ ਅਤੇ ਮੈਂ ਪੈਸਿਆਂ ਨੂੰ ਆਪਣਾ ਮਤਲਬ ਅ ਬਹੁਤ ਸਂਭਾਲ ਕੇ ਰੱਖਦੀ ਹਾਂ ਅਤੇ ਪੈਸਿਆਂ ਨੂੰ ਮਤਲਬ ਜਿਵੇਂ ਮੈਂ ਆਪਣੇ ਇੱਕ ਕੋਈ ਰਜਿਸਟਰ ਲਗਾਇਆ ਹੈ ਮੈਂ ਫਿਰ ਹਰ ਇੱਕ ਪੈਸੇ ਦਾ ਹਿਸਾਬ ਕਿਤਾਬ ਆਪਣਾ ਉੱਥੇ ਰਜਿਸਟਰ ਦੇ ਉੱਤੇ ਰੱਖ ਉੱਤੇ ਲਿਖ ਲੈਂਦੀ ਹਾਂ ਜੋ ਵੀ ਮੈਂ ਪੈਸਾ ਖਰਚਦੀ ਹਾਂ ਜੋ ਵੀ ਮਤਲਬ ਮੈਂ ਆਪਣਾ ਕਿਸੇ ਵੀ ਚੀਜ਼ 'ਤੇ ਲਗਾਉਂਦੀ ਹਾਂ ਉਹ ਸਾਰੇ ਪੈਸਿਆਂ ਦਾ ਮੈਂ ਆਪਣੇ ਕੋਲ ਹਿਸਾਬ ਰੱਖਿਆ ਹੋਇਆ ਹੈ ਤਾਂ ਉਹਦੇ ਵਾਸਤੇ ਸਪੈਸ਼ਲ ਇੱਕ ਰਜਿਸਟਰ ਲਗਾਇਆ ਹੈ ਅਤੇ ਪੂਰਾ ਹਿਸਾਬ ਕਿਤਾਬ ਮੈਂ ਨਾ ਪੈਸਿਆਂ 'ਤੇ ਰੱਖਦੀ ਹਾਂ ਕਿਉਂਕਿ ਸ਼ੁ ਮੇਰੇ ਸ਼ ਮੇਰੇ ਮੇਰੇ ਪਾਪਾ ਨੂੰ ਵੀ ਪੈਸੇ ਇਕੱਠੇ ਕਰਨ ਦਾ ਬਹੁਤ ਸ਼ੌਂਕ ਸੀ ਮੇਰੇ ਦਾਦਾ ਜੀ ਨੂੰ ਵੀ ਪੈਸੇ ਇਕੱਠੇ ਕਰਨ ਦਾ ਬਹੁਤ ਸੌਂਕ ਸੀ ਅਤੇ ਉਹਨਾਂ ਨੂੰ ਵੇਖ ਕੇ ਹੀ ਮੈਨੂੰ ਮਤਲਬ ਕਿ ਸਾਰੇ ਨੋਟਾਂ ਨੂੰ ਸਿੱਕਿਆਂ ਨੂੰ ਮੈਨੂੰ ਇਕੱਠੇ ਕਰਨ ਦਾ ਉਹਨਾਂ ਤੋਂ ਹੀ ਸ਼ੌਂਕ ਮਤਲਬ ਮੈਨੂੰ ਮਿਲਿਆ ਅਇਸ ਕਰਕੇ ਮੈਂ ਮਤਲਬ ਕਰਦੀ ਹਾਂ ਮੈਂ ਉਹਨਾਂ ਨੂੰ ਮਤਲਬ ਪੂਰਾ ਇੱਕ ਰਜਿਸਟਰ ਲਗਾ ਕੇ ਉਹਨਾਂ 'ਤੇ ਸਾਰਾ ਉਨ੍ਹਾਂ ਦਾ ਹਿਸਾਬ ਕਿਤਾਬ ਵਗੈਰਾ ਜਿਵੇਂ ਕਿ ਰੱਖ ਲੈਂਦੀ ਆ ਰੱਖ ਲੈਂਦੀ ਹਾਂ ਅਤੇ ਹੋਰ ਮਤਲਬ ਕੋਈ ਵੀ ਜਿਵੇਂ ਕਿ ਮੈਂ ਪੂਰਾ ਉਹਨਾਂ ਦਾ ਡਾਟਾ ਵਗੈਰਾ ਉਹਨਾਂ ਦਾ ਸਾਰਾ ਪੂਰਾ ਹੀ ਲਿਖ ਲੈਂਦੀ ਹਾਂ